ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਵਰਤੀਆਂ ਜਾਂਦੀਆਂ ਐਪ ਵਟਸਐਪ ਐਮਾਜ਼ੋਨ ਫਲਿੱਪਕਾਰਟ ਮੀਸ਼ੋ ਆਦਿ ਹਨ ਅਤੇ ਇਹਨਾਂ ਦੇ ਬਹੁਤ ਸਾਰੇ ਨੁਕਸਾਨ ਅਤੇ ਫਾਇਦੇ ਹਨ ਸਭ ਤੋਂ ਪਹਿ ਜ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਇਹਨਾਂ ਦੇ ਫਾਇਦਿਆਂ ਬਾਰੇ ਤਾਂ ਇਹ ਫਾਇਦਾ ਇਹ ਹੈ ਕਿ ਇਸ ਦੇ ਰਾਹੀਂ ਅਸੀਂ ਇੱਕ ਪਰਸਨ ਨਾਲ ਇੱਕ ਪਰਸਨ ਰਾ ਨਾਲ ਚੈਟ ਕਰ ਸਕਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਵੀਡੀਓ ਕੋਲ ਵੀ ਕਰ ਸਕਦੇ ਹਾਂ ਪਰ ਜੇਕਰ ਮੈਂ ਗੱਲ ਕਰਾਂ ਉਹਨਾਂ ਇਹਨਾਂ ਐਪਾਂ ਦੇ ਨੁਕਸਾਨ ਬਾਰੇ ਤਾਂ ਇਹਨਾਂ ਐਪਾਂ ਦੇ ਵਿੱਚ ਪਰਸਨ ਪਰਸਨ ਦੀ ਬਾਇਓ ਬਾਇਓਡਾਟਾ ਫਿੱਲ ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਦੇ ਬੈਂਕ ਨਾਲ ਰਿਲੇਟਡ ਸਬਜੈਕਟ ਵੀ ਫਿੱਲ ਕੀਤੇ ਹੁੰਦੇ ਹਨ ਅਤੇ ਕਈ ਹੈਕਰ ਉਹਨਾਂ ਬੈਂਕਾਂ ਅਕਾ ਅਕਾਊਂਟਸ ਨੂੰ ਹੈਕ ਕਰ ਲੈਂਦੇ ਹਨ ਅਤੇ ਉਹਨਾਂ ਲੋਕਾਂ ਨੂੰ ਬਲੈਕਮੇਲ ਕਰਦੇ ਹਨ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ